ਸਤਿ ਸ਼੍ਰੀ ਅਕਾਲ ਭਾਬੀ ਜੀ ਹੋਰ ਕਿਆ ਹਾਲ ਚਾਲ ਹੈ ਅਸੀਂ ਵੀ ਵਧੀਆ ਹੋਰ ਘਰ ਠੀਕ ਨੇ ਸਭ ਅੱਛਾ ਉਹ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ ਸਾਡੇ ਆਂਢ ਗੁਆਂਢ 'ਚ ਐਨਾ ਸ਼ੋਰ ਕਿਉਂ ਹੈ ਹਾਂ ਉਹ ਬਹੁਤ ਹੀ ਜ਼ਿਆਦਾ ਉੱਚੀ ਉੱਚੀ ਸਪੀਕਰ ਵੀ ਲਗਾਉਂਦੇ ਹਨ ਫੇਰ ਹੁਣ ਅਸੀਂ ਕੀ ਕਰੀਏ ਠੀਕ ਹੈ ਚਲੋ ਫੇਰ ਅਸੀਂ ਜਾ ਆਵਾਂਗੇ ਉਹਨਾਂ ਦੀ ਕੰਪਲੇਂਟ ਕਰ ਆਵਾਂਗੇ ਤੁਸੀਂ ਕਦੋਂ ਫ੍ਰੀ ਹੋ ਫੇਰ ਹਾਂਜੀ ਠੀਕ ਹੈ ਚਲੋ ਫੇਰ ਮੈਂ ਤੁਹਾਡੇ ਘਰ ਆਉਂਦੀ ਹਾਂ ਫੇਰ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ